ਲਾੱਕਡਾਊਨ ਦੇ ਵਿੱਚ ਅਸੀਂ ਆਪਣੇ ਘਰਾਂ ਦੇ ਵਿੱਚ ਰਹਿ ਕੇ ਕਈ ਘਰਾਂ ਦੇ ਪਕਵਾਨ ਪਣ ਪਕਾ ਕੇ ਖਾਂਦੇ ਰਹੇ ਲਾ ਕਿਉਂਕਿ ਲਾੱਕਡਾਊਨ ਦੇ ਵਿੱਚ ਬਾਜ਼ਾਰ ਜਾਣਾ ਮਾਰਕਿਟਾਂ ਵਿੱਚ ਜਾਣਾ ਹਰ ਇੱਕ ਚੀਜ਼ ਦੀ ਮਨਾਹੀ ਸੀ ਔਰ ਨਾ ਹੀ ਕੋਈ ਬਜ਼ਾਰ ਵਿੱਚ ਜਾਂ ਸੜਕਾਂ ਦੇ ਕਿਨਾਰਿਆਂ ਦੇ ਉੱਤੇ ਕਿਸੇ ਵੀ ਪ੍ਰਕਾਰ ਦੇ ਪਕਵਾਨ ਦੀ ਕੋਈ ਰੇਹੜੀ ਨਹੀਂ ਸੀ ਲੱਗਦੀ ਅਤੇ ਅਸੀਂ ਲਾੱਕਡਾਊਨ ਦੇ ਵਿੱਚ ਰਹਿ ਕੇ ਘਰ ਵਿੱਚ ਆਪਣੇ ਵਿੱਚ ਰਹਿ ਕੇ ਕਈ ਤਰ੍ਹਾਂ ਦੇ ਪਕਵਾਨ ਪਕਾ ਪਕਾ ਕੇ ਖਾਧੇ ਜਿਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਬਰੈਡ ਪਕੌੜਾ ਸੈਂਡਵਿੱਚ ਦਹੀਂ ਭੱਲਾ ਆਲੂ ਟਿੱਕੀ ਗੋਲਗੱਪਾ ਨਿਊਡਲਸ ਸਮੋਸਾ ਇਹ ਸਾਰੇ ਬਣਾ ਕੇ ਅਸੀਂ ਘਰਾਂ ਦੇ ਵਿੱਚ ਖਾਧੇ ਉਸ ਤੋਂ ਉਪਰੰਤ ਕਈ ਪ੍ਰਕਾਰ ਦੇ ਸਵੀਟਸ ਆਪਣੇ ਘਰ ਦੇ ਵਿੱਚ ਬਣਾ ਕੇ ਉਹ ਖਾਧੇ ਜਿਸ ਤਰ੍ਹਾਂ ਵੈਜਆਟੇਰੀਅਨ ਦੇ ਵਿੱਚ ਸਭ ਤੋਂ ਮਸ਼ਹੂਰ ਸ਼ਾਹੀ ਪਨੀਰ ਕੜ੍ਹੀ ਪਨੀਰ ਮਸਰੂਮ ਇਹ ਬਣਾ ਕੇ ਸਬਜ਼ੀਆਂ ਅਸੀਂ ਆਪਣੇ ਮਨ ਪਸੰਦ ਦੀਆਂ ਘਰ ਦੇ ਵਿੱਚ ਬਣਾ ਕੇ ਖਾਧੀਆਂ ਉਸ ਤੋਂ ਉਪਰੰਤ ਸਪਰਿੰਗ ਰੋਲ ਮੋਮੋਸ ਆਦਿ ਵੀ ਅਸੀਂ ਬਣਾ ਕੇ ਆਪਣੇ ਆਪਣੇ ਘਰ ਦੇ ਵਿੱਚ ਖਾਧੇ ਅਤੇ ਬਹੁਤ ਸਵਾਦ ਲੱਗੇ ਉਸੇ ਤਰ੍ਹਾਂ ਕਈ ਪ੍ਰਕਾਰ ਦੇ ਫ਼ਰੂਟਸ ਚਾਟ ਬਣਾ ਕੇ ਅਸੀਂ ਆਪਣੇ ਆਪਣੇ ਘਰ ਦੇ ਵਿੱਚ ਬੈਠ ਕੇ ਆਪਣੇ ਆਪਣੇ ਪਰਿਵਾਰ ਦੇ ਵਿੱਚ ਬਹੁਤ ਹੀ ਖੁਸ਼ੀ ਖੁਸ਼ੀ ਖਾਧੇ